ਨਹੀਂ ਮੈਨੂੰ ਨਹੀਂ ਲੱਗਦਾ ਕਿ ਹੋਰ ਗ੍ਰਹਿਆਂ 'ਤੇ ਜੀਵਨ ਹੈ ਜਿਵੇਂ ਕਿ ਧਰਤੀ 'ਤੇ ਸਾਨੂੰ ਪਾਣੀ ਮਿਲਦਾ ਹੈ ਹਵਾ ਮਿਲਦੀ ਹੈ ਪੇੜ ਪੌਦੇ ਮਿਲਦੇ ਹਨ ਜੇ ਅਸੀਂ ਹੋਰ ਗ੍ਰਹਿ ਦੀ ਗੱਲ ਕਰੀਏ ਜਿਵੇਂ ਕਿ ਚੰਦਰਮਾ ਤਾਂ ਚੰਦਰਮਾ 'ਤੇ ਸਾਨੂੰ ਪਾਣੀ ਹਵਾ ਪੇੜ ਪੋਦੇ ਜੋ ਕਿ ਸਾਨੂੰ ਜਿਊਣ ਲਈ ਬਹੁਤ ਜ਼ਰੂਰੀ ਹਨ ਪਾਣੀ ਤਾਂ ਸਾਡੀ ਬਹੁਤ ਹੀ ਖਾਸ ਜ਼ਰੂਰਤ ਹੈ ਜਿਸ ਨਾਲ ਸਾਡਾ ਜੀਵਨ ਹੇੈ ਜੇ ਉਹੀ ਚੀਜ਼ ਸਾਨੂੰ ਨਹੀਂ ਮਿਲੇਗੀ ਤਾਂ ਅਸੀਂ ਕਿਵੇਂ ਜੀਵਾਂਗੇ ਇਸ ਕਰਕੇ ਮੇਰਾ ਕਹਿਣਾ ਹੈ ਕਿ ਹੋਰ ਗ੍ਰਹਿਆਂ 'ਤੇ ਜਿਹੜਾ ਰਹਿਣਾ ਬਹੁਤ ਹੀ ਮੁਸ਼ਕਿਲ ਹੈ ਜਿਹੜਾ ਜੀਵਨ ਸਾਡਾ ਹੈ ਉਹ ਸਿਰਫ ਧਰਤੀ 'ਤੇ ਹੀ ਸਹੀ ਹੈ